ਕੰਪਨੀਆਂ ਸਪੋਂਸਰਸ਼ਿਪ ਨਿਵੇਸ਼ ਅਤੇ ਰਣਨੀਤਿਕ ਭਾਈਵਾਲੀ ਰਾਹੀਂ ਰਾਜ ਅਤੇ ਅੰਤਰਰਾਸ਼ਟਰੀ ਪੱਧਰਾਂ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਨਾਇਕੀ ਅਤੇ ਐਡੀਡਾਸ ਵਰਗੇ ਪ੍ਰਮੁੱਖ ਗਲੋਬਲ ਬਰਾਂਡ ਅਥਲੀਟਾਂ ਟੀਮਾਂ ਅਤੇ ਫੀਫਾ ਵਿਸ਼ਵ ਕੱਪ ਯੂ ਆਈ ਐਫ ਏ ਚੈਂਪੀਅਨਜ਼ ਲੀਗ ਅਤੇ ਓਲੰਪਿਕ ਵਰਗੇ ਉੱਚ ਪ੍ਰੋਫਾਈਲ ਇਵੈਂਟਾਂ ਨੂੰ ਸਪਾਂਸਰ ਕਰਦੇ ਹਨ ਮਹੱਤਮਪੂਰਨ ਤੌਰ 'ਤੇ ਪ੍ਰਭਾਵਿਤ ਕਰਦੇ ਹਨ ਉਹਨਾਂ ਦੀ ਵਿੱਤੀ ਸਹਾਇਤਾ ਇਵੈਂਟ ਦੀਆਂ ਲਾਗਤਾਂ ਨੂੰ ਕਵਰ ਕਰਨ ਟੀਮ ਦੀਆਂ ਸਮਰਥਾਵਾਂ ਨੂੰ ਵਧਾਉਣ ਅਤੇ ਜਰਸੀ ਦੇ ਪ੍ਰਚਾਰ ਸਮੱਗਰੀ ਤੇ ਬਰਾਈਡਿੰਗ ਦੁਆਰਾ ਗਲੋਬਲ ਨੂੰ ਦਿੱਖ ਨੂੰ ਵਧਾਉਂਦੀ ਹੈ ਕੋਕਾ ਕੋਲਾ ਅਤੇ ਪੈਪਸੀਕੋ ਵਰਗੀਆਂ ਕੰਪਨੀਆਂ ਵਿਆਪਕ ਮਾਰਕੀਟ ਮੁਹ ਮੁਹਿੰਮ ਵਿੱਚ ਸ਼ਾਮਿਲ ਹੁੰਦੀਆਂ ਹਨ ਨਾ ਜੋ ਸਿਰਫ ਉਹਨਾਂ ਦੇ ਉਤਪਾਦਾਂ ਦਾ ਪ੍ਰਚਾਰ ਕਰਦੀਆਂ ਹਨ ਸਗੋਂ ਖੇਡਾਂ ਦੇ ਪ੍ਰੋਗਰਾਮਾਂ ਦੀ ਪ੍ਰੋਫਾਈਲ ਨੂੰ ਵੀ ਵਧਾਉਂਦੀਆਂ ਹਨ ਜਿਸ ਨਾਲ ਦਰਸ਼ਕਾਂ ਦੀ ਵਿਆਪਕ ਭਾਗੀਦਾਰੀ ਅਤੇ ਦਰਸ਼ਕਾ ਨੂੰ ਉਤਸਾਹਿਤ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਰੈਡ ਬੁਲ ਅਤੇ ਅੰਤ ਖੇਡਾਂ ਵਿੱਚ ਨਿਵੇਸ਼ ਕਰਦਾ ਹੈ ਅਤੇ ਖੇਡਾਂ ਦੇ ਮਨੋਰੰਜਨ ਅਤੇ ਨਵੀਨਤਾ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਂਦੇ ਹੋਏ ਰੈਡ ਬੁੱਲ ਰੇਸ਼ਿੰਗ ਅਤੇ ਰੈਡ ਬੁੱਲ ਕਲਿਪ ਡਰਾਈਵਿੰਗ ਵਰਲਡ ਸੀਰੀਜ਼ ਵਰਗੀਆਂ ਟੀਮਾਂ ਅਤੇ ਇਵੈਂਟਾਂ ਦਾ ਮਾਲਕ ਹੈ ਟੂਰਨਾਮੈਂਟਾਂ ਨੂੰ ਸਪੋਂਸਰ ਕਰਕੇ ਗੇਮਿੰਗ ਟੈਕਨੋਲਜੀ ਵਿਕਸਿਤ ਕਰਕੇ ਅਤੇ ਪ੍ਰਤੀਯੋਗੀ ਗੇਮਾਂ ਅਨੁਭਵ ਨੂੰ ਵਧਾ ਕੇ ਈ ਸਪੋਰਟਸ ਦੇ ਵਾਧੇ ਵਿੱਚ ਯੋਗਦਾਨ ਪਾਉਂਦੇ ਹਨ ਜੋ ਕੀ ਖੇਤਰ ਦੀ ਵਿਸ਼ਵ ਵਿਆਪੀ ਪਹੁੰਚ ਨੂੰ ਉੱਚਾ ਚੁੱਕਦਾ ਹੈ ਅਮੀਰਤਾ ਏਅਰਲਾਈਨਜ ਅਤੇ ਸੋਨੀ ਅੰਤਰਰਾਸ਼ਟਰੀ ਖੇਡਾਂ ਸਮਾਗਮਾਂ ਲਈ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਦੇ ਹਨ ਗਲੋਬਲ ਕਨੈਕਸ਼ਨਾਂ ਦੀ ਸਹੂਲਤਾਂ ਦਿੰਦੇ ਹਨ ਅਤੇ ਤਕਨੀਕੀ ਤਰੱਕੀ ਦੀ ਪੇਸ਼ਕਸ਼ ਕਰਦੇ ਹਨ ਜੋ ਖੇਡਾਂ ਦੇ ਪ੍ਰਸਾਰਨ ਅਤੇ ਅਨੁਭਵਾਂ ਦੀ ਗੁਣਵੱਤਾ ਨੂੰ ਵਧਾਉਂਦੇ ਹਨ ਵਿੱਤੀ ਸਰੋਤਾਂ ਮਾਰਕੀਟਿੰਗ ਸ਼ਕਤੀ ਅਤੇ ਤਕਨੀਕੀ ਨਵੀਨਤਾਵਾਂ ਨੂੰ ਏਕੀਕ੍ਰਿਤ ਕਰਕੇ ਇਹ ਕੰਪਨੀਆਂ ਸਥਾਨਕ ਲੀਗਾਂ ਤੋਂ ਲੈ ਕੇ ਪ੍ਰਮੁੱਖ ਅੰਤਰਰਾਸ਼ਟਰੀ ਮੁਕਾਬਲਿਆਂ ਤੱਕ ਹਰ ਪੱਧਰ ਤੇ ਖੇਡਾਂ ਵਿਕਾਸ ਤਰੱਕੀ ਅਤੇ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ